ਉੱਨੀ ਦਸ ਦੋ ਹਜ਼ਾਰ ਛੇ ਅੱਠ ਦੋ ਹਜ਼ਾਰ ਇੱਕ ਸੱਤ ਇੱਕ ਦੋ ਹਜ਼ਾਰ ਤੇਈ ਅੱਠ ਦਸ ਦੋ ਹਜ਼ਾਰ ਇੱਕੀ ਤਿੰਨ ਚਾਰ ਦੋ ਹਜ਼ਾਰ ਚਾਰ